ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਭਾਅ ਜੀ ਠੀਕ ਹੈ ਜੀ ਓਹ ਅੱਛਾ ਅੱਛਾ ਮੈਨੂੰ ਹਾਂਜੀ ਹਾਂਜੀ ਹਾਂ ਠੀਕ ਹੈ ਕੋਈ ਗੱਲ ਨਹੀਂ ਭਾਅ ਜੀ ਫੂਡ ਇੱਥੇ ਆਪਣਾ ਅੰਮ੍ਰਿਤਸਰ ਲੋਕਲ ਵੀ ਅਤੇ ਤੁਹਾਨੂੰ ਪਤਾ ਕੁਲਚੇ ਅਤੇ ਲੱਸੀ ਬਹੁਤ ਫੇਮਸ ਹੈ ਬਾਕੀ ਜਿਹੜਾ ਫਾਸਟ ਫੂਡ ਹੈਗਾ ਜੀ ਉਹ ਭਾਅ ਜੀ ਆਪਣਾ ਅਜੀਤ ਨਗਰ ਦਾ ਬਹੁਤ ਫੇਮਸ ਹੈ ਸਿਟੀ ਦੇ ਕੋਲ ਹੈ ਸ਼ਹਿਰ 'ਚ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਅਤੇ ਕ੍ਰਿਸਟਲ ਚੌਂਕ ਦੇ ਬਿਲਕੁਲ ਸਾਹਮਣੇ ਹੈਗੀ ਰੇਹੜੀ ਮਾਰਕੀਟ ਉੱਥੇ ਤੁਹਾਨੂੰ ਡੋਸਾ ਟਿੱਕੀ ਇਡਲੀ ਚਾਂਪ ਵਗੈਰਾ ਸਭ ਕੁਛ ਮਿਲਦਾ ਤੁਸੀਂ ਉੱਥੇ ਜਾ ਕੇ ਵੀ ਟਰਾਈ ਕਰ ਸਕ ਹਾਂਜੀ ਹਾਂਜੀ ਕੁਲਚਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਲਦਾ ਜੀ ਅਤੇ ਤੁਸੀਂ ਜਦੋਂ ਮਰਜ਼ੀ ਆਓ ਟਰਾਈ ਕਰੋ ਫਾਸਟ ਫੂਡ 'ਚ ਭਾਅ ਜੀ ਉਹੀ ਚਲਦਾ ਚਾਂਪ ਵਗੈਰਾ ਵੈੱਜ 'ਚ ਤਾਂ ਇਹੋ ਚੱਲਦਾ ਚਾਂਪ ਹੋਗੀ ਟਿੱਕੀ ਹੋ ਗਈ ਨਿਊਡਲਸ ਹੋ ਗਏ ਬਰਗਰ ਹੋ ਗਏ ਬਾਕੀ ਨੋਨ ਵੈੱਜ ਨਹੀਂ ਨਹੀਂ ਕੋਈ ਗੱਲ ਨਹੀਂ ਭਾਅ ਜੀ ਜਦੋਂ ਮਰਜ਼ੀ ਠੀਕ ਆ ਭਾਅ ਜੀ ਜਦੋਂ ਮਰਜ਼ੀ ਕਾਲ ਕਰੋ ਕੋਈ ਚੱਕਰ ਨਹੀਂ ਓਕੇ ਭਾਅ ਜੀ ਓਕੇ ਜੀ ਸ਼ੁਕਰੀਆ